ਯੋਗਾ ਦੇ ਇੱਕ ਦੋ ਪਹਿਲੂ ਚੁਣੌਤੀਪੂਰਨ ਹਨ ਪਹਿਲਾ ਕਿ ਇਸ ਨੂੰ ਰੋਜ਼ ਜਾਰੀ ਰੱਖਣਾ ਕਿਉਂਕਿ ਕੁਝ ਸਮਾਂ ਬਾਅਦ ਯੋਗ ਦੀ ਆਦਤ ਛੁੱਟ ਜਾਂਦੀ ਹੈ ਤਾਂ ਦੁਬਾਰਾ ਰੂਟੀਨ ਸ਼ੁਰੂ ਕਰਨ ਨੂੰ ਦਿਲ ਹੀ ਨਹੀਂ ਕਰਦਾ ਦੂਸਰਾ ਕਦੇ ਕਦੇ ਮਾਸਪੇਸ਼ੀਆਂ ਨੂੰ ਕਮਜ਼ੋਰੀ ਕਰਕੇ ਖਿੱਚ ਪੈ ਜਾਂਦੀ ਹੈ ਠੰਡੇ ਗਰਮ ਦੇ ਖਾਣ ਪਾਨ ਦਾ ਧਿਆਨ ਰੱਖਣਾ ਹੁੰਦਾ ਹੈ ਫਿਰ ਵੀ ਕੁਝ ਮਿਰ ਮਿਨਟ ਨਾਲ ਅਸੀਂ ਰੂਟੀਨ ਸਹੀ ਕਰ ਲੈਂਦੇ ਹਾਂ ਯੋਗਾ ਨਾਲ ਜੀਵਨ ਸੁਖਾਵਾਂ ਬਣਦਾ ਹੈ ਛੋਟੇ ਮੋਟੇ ਰੋਗ ਤਾਂ ਨੇੜੇ ਹੀ ਨਹੀਂ ਆਉਂਦੇ